ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਜਿਹੜਾ ਹੈਗਾ ਔਨਲਾਈਨ ਜਿਹੜੀ ਸ਼ੌਪਿੰਗ ਹੈ ਉਹ ਆਪਣੇ ਜਿਹੜੇ ਲਾਈਫ ਹੈ ਆਪਣੀ ਜ਼ਿੰਦਗੀ ਆ ਉਹਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ ਲੇਕਿਨ ਕਦੇ ਕਦੇ ਔਨਲਾਈਨ ਸ਼ੌਪਿੰਗ ਕਰਨਾ ਥੋੜ੍ਹਾ ਜਿਹਾ ਰਿਸਕੀ ਲੱਗਦਾ ਹੈ ਮੈਨੂੰ ਕਿਉਂਕਿ ਕਦੇ ਕਦੇ ਤੁਹਾਨੂੰ ਜੋ ਪ੍ਰੋਡਕਟ ਦਿਖਾਇਆ ਜਾਂਦਾ ਹੈ ਉਹ ਕਦੇ ਕਦੇ ਬੁਰਾ ਵੀ ਨਿਕਲ ਜਾਂਦਾ ਹੈ ਵਧੀਆ ਵੀ ਨਹੀਂ ਨਿਕਲਦਾ ਹੈਗਾ ਜਿਵੇਂ ਮੈਨੂੰ ਹੁਣ ਆਪਣਾ ਇੱਕ ਜ਼ਿੰਦਗੀ ਦਾ ਲਾਈਫ ਦਾ ਐਕਸਪੀਰੀਅੰਸ ਹੈਗਾ ਇੱਕ ਪ੍ਰੋਡਕਟ ਦੇ ਵਿੱਚ ਮੈਂ ਇੱਕ ਸਕਰਟ ਔਡਰ ਕੀਤੀ ਸੀ ਕਿਸੇ ਐਪ ਤੋਂ ਔਨਲਾਈਨ ਐਪ ਤੋਂ ਅਤੇ ਮੈਨੂੰ ਜਿਹੜੀ ਉਹ ਸਕਰਟ ਹੈ ਦਿਖਾਈ ਗਈ ਸੀ ਕਿ ਉਹ ਜਿਹੜੀ ਹੈਗੀ ਹੈ ਸਕਰਟ ਸੈਟਿਨ ਦੀ ਹੈ ਸੈਟਿਨ ਉਹਦਾ ਫੈਬਰਿਕ ਹੈਗਾ ਸੀ ਅਤੇ ਮੈਂ ਚੈੱਕ ਵੀ ਕੀਤਾ ਹੈ ਮੈਂ ਸਾਰੇ ਰਿਵਿਊ ਵੀ ਚੈੱਕ ਕੀਤੇ ਨੇ ਅਤੇ ਉੱਥੇ ਵਧੀਆ ਦਿਖਾਇਆ ਹੋਇਆ ਸੀ ਕਿ ਹਾਂ ਇੱਦਾਂ ਦਾ ਮਟੀਰੀਅਲ ਹੈ ਅਤੇ ਵਧੀਆ ਮੈਟੀਰੀਅਲ ਹੈ ਅਤੇ ਉਹਦਾ ਜਿਹੜਾ ਪ੍ਰਾਈਜ਼ ਹੈ ਪੰਜ ਸੌ ਸੀ ਅਤੇ ਮੈਨੂੰ ਲੱਗਿਆ ਕਿ ਵਧੀਆ ਸਕਰਟ ਹੈ ਅਤੇ ਮੈਂ ਉਹਨਾਂ ਨੂੰ ਮੈਂ ਔਡਰ ਵੀ ਕੀਤੀ ਹੈ ਅਤੇ ਪੰਜ ਛੇ ਦਿਨ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਹੈਗਾ ਕਿਹਾ ਸੀ ਕਿ ਉਹ ਕਰ ਦੇਣਗੇ ਪਲੇਸ ਔਡਰ ਬਟ ਲੇਕਿਨ ਦਸ ਦਿਨ ਉਹਨਾਂ ਨੇ ਲਿੱਤੇ ਅਤੇ ਉਸ ਤੋਂ ਬਾਅਦ ਵੀ ਜਿਹੜੀ ਸਕਰਟ ਹੈ ਉਹ ਜਿਹੜੀ ਸੈਟਿਨ ਫੈਬਰਿਕ ਦੀ ਨਹੀਂ ਆਈ ਉਹਦਾ ਜਿਹੜਾ ਮੈਟੀਰੀਅਲ ਸੀ ਸਕਰਟ ਦਾ ਬੜਾ ਗੰਦਾ ਸੀ ਬ ਬਿਲਕੁਲ ਵੀ ਚੱਜ ਦੀ ਨਹੀਂ ਸੀ ਬਿਲਕੁਲ ਵੀ ਮੈਂ ਜਿਹੜੀ ਹੈਗੀ ਆ ਉਹ ਦੁਬਾਰਾ ਉਹਨੂੰ ਕੰਪਲੇਂਟ ਵੀ ਕੀਤੀ ਕਿ ਇੱਦਾਂ ਦਾ ਇਹਦਾ ਫੈਬਰਿਕ ਆਇਆ ਪਲੀਜ਼ ਇਹਨੂੰ ਲੈ ਕੇ ਜਾਓ ਲੇਕਿਨ ਉਹਨੇ ਕਿਹਾ ਕਿ ਸਾਡੀ ਜਿਹੜੀ ਬੈਕ ਹੈ ਬੈਕ ਦੀ ਪੋਲਿਸੀ ਆ ਉਹ ਖ਼ਤਮ ਹੈ ਹੋ ਚੁੱਕੀ ਹੈ ਅਸੀਂ ਨਹੀਂ ਲੈ ਸਕਦੇ ਹੈਗੇ ਹੁਣ ਪਹਿਲਾਂ ਸਾਡੇ ਐਪ ਦੇ ਵਿੱਚ ਪੋਲਿਸੀ ਹੁੰਦੀ ਸੀ ਰਿਟਰਨ ਦੀ ਬਟ ਹੁਣ ਨਹੀਂ ਹੈ ਅਤੇ ਉਹ ਜਿਹੜੀ ਸਕਰਟ ਹੈ ਮੈਨੂੰ ਬੜਾ ਬੁਰਾ ਲੱਗਿਆ ਉਸਦਾ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਪ੍ਰੋਡਕਟ ਸੀ ਉਹ ਚੰਗਾ ਨਹੀਂ ਸੀ ਬਿਲਕੁਲ ਵੀ ਅਤੇ ਮੈਂ ਆਪਣੇ ਪੰਜ ਸੌ ਜ ਰੁਪਏ ਵੀ ਜਿਹੜੇ ਹੈਗੇ ਆ ਉਹ ਖ਼ਰਾਬ ਕਰਤੇ ਸੀ